ਕਲਾ ਕਿਸੇ ਤਰ੍ਹਾਂ ਦੀ ਵੀ ਹੋਵੇ ਉਹ ਰੱਬ ਦੀ ਦਾਤ ਹੁੰਦੀ ਹੈ ਅਤੇ ਜਿੱਥੋਂ ਤੱਕਰ ਗੱਲ ਹੈ ਗੁਰੂ ਦੇ ਹੋਣ ਦੀ ਤਾਂ ਬੇਸ਼ੱਕ ਇਸ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਮੈਂ ਮਿਉਜ਼ਿਕ ਵੋਕਲ ਦੀ ਸਟੂਡੈਂਟ ਰਹਿ ਚੁੱਕੀ ਹਾਂ ਮੈਂ ਗਿਆਰ੍ਹਵੀਂ ਕਲਾਸ ਦੇ ਵਿੱਚ ਪਹਿਲੀ ਵਾਰੀ ਮਿਊਜਿਕ ਨੂੰ ਐਜ਼ ਆ ਸਬਜੈਕਟ ਲਿੱਤਾ ਸੀ ਅਤੇ ਜਦੋਂ ਮੈਂ ਕਾਲਜ 'ਚ ਗਈ ਤਾਂ ਮੇਰੀ ਟੀਚਰ ਨੇ ਮੇਰੇ ਅਧਿਆਪਕ ਨੇ ਸਿਰਫ ਮੇਰੀ ਆਵਾਜ਼ ਸੁਣੀ ਸੀ ਜਦਕਿ ਸੁਰਾਂ ਦੀ ਪਹਿਚਾਣ ਮੈਨੂੰ ਉਹਨਾਂ ਨੇ ਕਰਵਾਈ ਅਤੇ ਮੇਰੇ ਹਿਸਾਬ ਨਾਲ ਬਿਲਕੁਲ ਹੀ ਇੱਕ ਗੁਰੂ ਹੋਣਾ ਜ਼ਰੂਰੀ ਹੈ ਇੱਕ ਹੁਨਰ ਨੂੰ ਪਹਿਚਾਨਣ ਵਾਲਾ ਗੁਰੂ ਹੀ ਹੁੰਦਾ ਹੈ ਤੁਸੀਂ ਕਿੱਥੋਂ ਤੱਕ ਕਿੰਨਾ ਵਧੀਆ ਗਾ ਸਕਦੇ ਉੱਚੇ ਨੀਵੇਂ ਸੁਰ ਕਿਵੇਂ ਲਾਣੇ ਨੇ ਰਾਗ ਕਿਵੇਂ ਗਾਣੇ ਨੇ ਕਿੰਨੇ ਤਰ੍ਹਾਂ ਦੇ ਰਾਗ ਹੁੰਦੇ ਨੇ ਕਿਹੜਾ ਰਾਗ ਕਿਸ ਤਰੀਕੇ ਦਾ ਹੁੰਦਾ ਹੈ ਉਹ ਸਭ ਸਾਨੂੰ ਗੁਰੂ ਸਿਖਾਂਦਾ ਅਤੇ ਬਿਲਕੁਲ ਮੇਰੀ ਜਿਹੜੀ ਗੁਰੂ ਸੀ ਉਹਨਾਂ ਦਾ ਨਾਮ ਸੀ ਮੈਡਮ ਰੇਨੂਕਾ ਮੇਰਾ ਉਹਨਾਂ ਦੇ ਨਾਲ ਬਹੁਤ ਹੀ ਵਧੀਆ ਅਨੁਭਵ ਰਿਹਾ ਕਿਉਂਕਿ ਗਿਆਰ੍ਹਵੀਂ ਕਲਾਸ ਤੋਂ ਲੈ ਕੇ ਮੇਰੀ ਬੀਏ ਫਾਈਨਲ ਈਅਰ ਤੱਕਰ ਮੈਂ ਉਹਨਾਂ ਕੋਲੋਂ ਹੀ ਪੜ੍ਹੀ ਹਾਂ ਔਰ ਹਰ ਤਰ੍ਹਾਂ ਦੇ ਨੁਕਸ ਵੀ ਹਰ ਬੱਚੇ 'ਚ ਹੁੰਦੇ ਨੇ ਸਾਨੂੰ ਉਹਨਾਂ ਨੇ ਉਹ ਵੀ ਦੱਸਿਆ ਅਤੇ ਹਰ ਤਰੀਕੇ ਨਾਲ ਸਾਨੂੰ ਉਹਨਾਂ ਨੇ ਤਰਾਸ਼ਿਆ ਜਿਵੇਂ ਕਿ ਆਵਾਜ਼ ਉਹਨਾਂ ਨੇ ਪਹਿਚਾਨੀ ਅਤੇ ਸੁਰ ਉਹਨਾਂ ਨੇ ਦਿੱਤੇ ਜੋ ਮੈਂ ਕਹਿ ਸਕਦੀ ਹਾਂ ਬਿਕੋਜ਼ ਸੁਰਾਂ ਨੂੰ ਇੱਕ ਗੁਰੂ ਹੀ ਪਹਿਚਾਣ ਸਕਦਾ ਹੈ ਬੜੇ ਚੰਗੇ ਤਰੀਕੇ ਨਾਲ ਔਰ ਮੇਰਾ ਅਨੁਭਵ ਮੇਰੀ ਟੀਚਰ ਦੇ ਨਾਲ ਬਹੁਤ ਹੀ ਵਧੀਆ ਰਿਹਾ ਸੀ ਧੰਨਵਾਦ